ਮੈਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਕਿਉਂਕਿ ਪੰਜਾਬ ਮੈਨੂੰ ਪੰਜਾਬ ਵਾਸੀ ਹੋਣ 'ਤੇ ਬਹੁਤ ਹੀ ਮਾਣ ਹੈ ਕਿਉਂਕਿ ਇੱਥੇ ਸਾਰੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਜ਼ਿਆਦਾਤਰ ਕਰਦੇ ਹਨ ਮੇਰੇ 'ਚ ਮੈਨੇ ਪੰਜਾਬੀ ਭਾਸ਼ਾ ਤਾਂ ਜ ਆਪਣੇ ਪਰਿਵਾਰ ਤੋਂ ਹੀ ਸਿੱਖੀ ਹੈ ਤਾਂ ਕਰਕੇ ਜਦੋਂ ਫਿਰ ਮੈਂ ਥੋੜ੍ਹੀ ਜਿਹੀ ਵੱਡੀ ਹੋਈ ਤਾਂ ਮੇਰੇ ਮਾਪਿਆਂ ਨੇ ਮੈਨੂੰ ਸਕੂਲ ਵਿੱਚ ਪਾ ਦਿੱਤਾ ਜਿਸ ਵਿੱਚ ਮੈਨੂੰ ਮੇਰੇ ਪੰਜਾਬੀ ਵਾਲੇ ਮੈਡਮ ਨੇ ਅੱਖਰਾਂ ਦੀ ਸਹੀ ਬਣਤਰ ਬਾਰੇ ਵੀ ਦੱਸਿਆ ਅਤੇ ਬੋਲੀ ਬਾਰੇ ਬੋਲਣ ਬਾਰੇ ਸਹੀ ਅਨੁਭਵ ਦਿੱਤਾ ਇਸ ਕਰਕੇ ਮੈਨੂੰ ਬਹੁਤ ਹੀ ਵਧੀਆ ਤਰ੍ਹਾਂ ਮੇਰੀ ਪੰਜਾਬੀ ਇੰਪਰੂਵ ਹੋ ਗਈ ਅਤੇ ਮੇਰਾ ਬਹੁਤ ਹੀ ਵਧੀਆ ਅਨੁਭਵ ਰਿਹਾ ਪੰਜਾਬੀ ਭਾਸ਼ਾ ਨਾਲ਼ ਤਾਂ ਕਰਕੇ ਮੈਨੂੰ ਬਹੁਤ ਹੀ ਵਧੀਆ ਪੰਜਾਬੀ ਭਾਸ਼ਾ ਲੱਗਦੀ ਹੈ